ਹੈਲੋ ਸਰ ਓਲਾ ਕੰਪਨੀ ਤੋਂ ਬੋਲਦੇ ਪਏ ਜੇ ਸਰ ਅਸੀਂ ਤੁਹਾਡੇ ਕੋਲੋਂ ਕੈਬ ਬੁੱਕ ਕਰਵਾਈ ਸੀ ਕੈਬ ਪੀ ਬੀ ਨੰਬਰ ਜ਼ੀਰੋ ਇੱਕ ਸੌ ਅਠਾਹਠ ਅਸੀਂ ਅਨੰਦਪੁਰ ਸਾਹਿਬ ਜਾਣਾ ਸੀ ਸਾਡਾ ਸਾਰਾ ਪਰਿਵਾਰ ਨਾਲ ਜਾ ਰਿਹਾ ਸੀ ਅਸੀਂ ਭੁਗਤਾਨ ਦੋ ਹਜ਼ਾਰ ਰੁਪਏ ਅਡਵਾਂਸ ਵਿੱਚ ਦਿੱਤੇ ਹਨ ਪਰ ਅਸੀਂ ਇਹ ਕੈਬ ਰੱਦ ਕਰਨਾ ਚਾਹੁੰਦੇ ਹਾਂ ਕਿਉਂਕਿ ਸਾਡੇ ਰਿਸ਼ਤੇਦਾਰਾਂ ਵਿੱਚ ਮਰਗ ਹੋ ਚੁੱਕੀ ਹੈ ਅਸੀਂ ਸਾਰੇ ਉੱਥੇ ਜਾਣਾ ਹੈ ਇਸ ਲਈ ਅਸੀਂ ਆਪਣਾ ਪ੍ਰੋਗਰਾਮ ਰੱਦ ਕਰਕੇ ਅੱਗੇ ਕਰ ਦਿੱਤਾ ਹੈ ਅਸੀਂ ਆਪਣੇ ਦੋ ਹਜ਼ਾਰ ਰੁਪਏ ਵਾਪਿਸ ਲੈਣਾ ਚਾਹੁੰਦੇ ਹਾਂ ਇਹ ਭੁਗਤਾਨ ਤੁਸੀਂ ਫੋਨ ਪੇ ਗੂਗਲ ਪੇ ਅਤੇ ਬੈਂਕ ਖਾਤੇ ਵਿੱਚ ਵੀ ਪਾ ਸਕਦੇ ਹੋ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ